ਪੰਜਾਬ ਵਿੱਚ ਕੁਛ ਸ਼ਹਿਰ ਨੇ ਜਿਹੜੇ ਬਹੁਤ ਛੋਟੇ ਨੇ ਕੁਝ ਕੁ ਸ਼ਹਿਰ ਆ ਜਿਹੜੇ ਬਹੁਤ ਵੱਡੇ ਵੱਡੇ ਨੇ ਇਹਨਾਂ ਵਿੱਚ ਆਬਾਦੀ ਵੀ ਬਹੁਤ ਹੈ ਆਰਥਿਕਤਾ ਦੀ ਵੀ ਮਤਲਬ ਕਿ ਜਿਹੜੀ ਬੁਨਿਆਦੀ ਢਾਂਚਾ ਉਹ ਵੀ ਬਹੁਤ ਵਧੀਆ ਸੱਭਿਆਚਾਰ ਵੀ ਹੈਗਾ ਗੱਲ ਕੀਤੀ ਜਾਵੇ ਮੋਹਾਲੀ ਦੀ ਮੋਹਾਲੀ ਜਿਲ੍ਹੇ ਵਿੱਚ ਸਭ ਤੋਂ ਉੱਪਰ ਜਾ ਰਿਹਾ ਕਿਉਂਕਿ ਇੱਧਰ ਜ਼ਿਆਦਾ ਜਿਹੜੇ ਚੰਡੀਗੜ੍ਹ ਨਾਲ ਲ ਲੱਗਦਾ ਏਰੀਆ ਇੱਥੇ ਲੋਕ ਬਹੁਤ ਜ਼ਿਆਦਾ ਮਤਲਬ ਕਿ ਬਾਹਰ ਤੋਂ ਆ ਰਹੇ ਨੇ ਜਿੱਦਾਂ ਹੋ ਗਿਆ ਆਪਣਾ ਅੰਮ੍ਰਿਤਸਰ ਤੋਂ ਚਲੇ ਗਏ ਬਠਿੰਡੇ ਤੋਂ ਚਲੇ ਗਏ ਇੱਦਾਂ ਇੱਦਾਂ ਮਤਲਬ ਪੰਜਾਬ ਦੇ ਪੂਰੇ ਏਰੀਏ ਦੇ ਜਿਹੜੇ ਲੋਕ ਨੇ ਉਹ ਜ਼ਿਆਦਾਤਰ ਮੋਹਾਲੀ ਜਿਲ੍ਹੇ ਵਿੱਚ ਰਹਿੰਦੇ ਨੇ ਜਿੱਦਾਂ ਦੀ ਨੌਕਰੀ ਹੈ ਚੰਡੀਗੜ੍ਹ ਲੱਗ ਜਾਂਦੀ ਹੈ ਹੋਰ ਗੱਲ ਕੀਤੀ ਜਾਵੇ ਜਲੰਧਰ ਦੀ ਜਲੰਧਰ ਵਿੱਚ ਮਤਲਬ ਕਿ ਜਿਹੜਾ ਸਪੋਰਟਸ ਦਾ ਸਮਾਨ ਹੈ ਉਹ ਜ਼ਿਆਦਾ ਬਹੁਤ ਜ਼ਿਆਦਾ ਮਸ਼ਹੂਰ ਹੈ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦਾ ਜਿਹੜਾ ਗਰਮ ਕੱਪੜਾ ਉਹ ਪੂਰੇ ਵਰਲਡ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਦਾਂ ਹੀ ਜਿਹੜੇ ਉਹ ਆਪਣੇ ਆਰਥਿਕਤਾ ਬਹੁਤ ਜ਼ਿਆਦਾ ਮਜ਼ਬੂਤ ਕਰਦੇ